ਮੈਨੂੰ ਜਗਜੀਤ ਸਿੰਘ ਸਭ ਤੋਂ ਵਧੀਆ ਗਜ਼ਲ ਗਾਇਕ ਲੱਗਦੇ ਹਨ ਉਹਨਾਂ ਦੇ ਗੀਤਾਂ ਵਿੱਚ ਗਹਿਰਾਈ ਇਮੋਸ਼ਨਸ ਅਤੇ ਸਿੰਪਲੀਸਿਟੀ ਹੁੰਦੀ ਹੈ ਜੋ ਕਿ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀ ਹੈ ਜਗਜੀਤ ਸਿੰਘ ਦੀ ਆਵਾਜ਼ ਬਹੁਤ ਹੀ ਮਿੱਠੀ ਸੁਰੀਲੀ ਅਤੇ ਸੋਲਫੁਲ ਸੀ ਜਿਸ ਕਰਕੇ ਉਹਨਾਂ ਦੀਆਂ ਗਜ਼ਲਾਂ ਦੁੱਖ ਇਸ਼ਕ ਅਤੇ ਜ਼ਿੰਦਗੀ ਦੀ ਹਕੀਕਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਉਂਦੀਆਂ ਸਨ ਉਹਨਾਂ ਗਜ਼ਲਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਗਿਆ ਕਿਉਂਕਿ ਉਹ ਆਸਾਨ ਭਾਸ਼ਾ ਵਿੱਚ ਗਾਉਂਦੇ ਸਨ ਜਿਸ ਕਰਕੇ ਹਰ ਕਿਸੇ ਨੂੰ ਉਹਨਾਂ ਦੀ ਗਜ਼ਲ ਸਮਝ ਆਉਂਦੀ ਸੀ ਉਹਨਾਂ ਦੀਆਂ ਕੁਝ ਮਸ਼ਹੂਰ ਗਜ਼ਲਾਂ ਇਸ ਤਰ੍ਹਾਂ ਹਨ ਹੋਸ਼ ਵਾਲੋਂ ਕੋ ਖ਼ਬਰ ਕਿਆ ਇਹ ਗਜ਼ਲ ਇਸ਼ਕ ਦੀ ਤਕਲੀਫ਼ ਅਤੇ ਖੋਏ ਹੋਏ ਪਿਆਰ ਦੀ ਯਾਦ ਦਿਲਾਉਂਦੀ ਹੈ ਤੁਮ ਇਤਨਾ ਜੋ ਮੁਸਕਰਾ ਰਹੇ ਹੋ ਇਹ ਗਜ਼ਲ ਦਿਲ ਤੋੜਨ ਵਾਲੀਆਂ ਯਾਦਾਂ ਬਿਆਨ ਕਰਦੀ ਹੈ ਚਿੱਠੀ ਨਾ ਕੋਈ ਸੰਦੇਸ਼ ਵਿਛੋੜੇ ਦੀ ਤਕਲੀਫ਼ ਨੂੰ ਬਹੁਤ ਸੋਹਣੇ ਢੰਗ ਨਾਲ ਦਰਸਾਉਂਦੀ ਹੈ ਕਿਸੇ ਦੀ ਯਾਦ ਵਿੱਚ ਪੁਰਾਣੀਆਂ ਯਾਦਾਂ ਦੀ ਨਰਮੀ ਅਤੇ ਇਮੋਸ਼ਨ ਭਰੀ ਗਜ਼ਲ ਧੰਨਵਾਦ